ਮੈਂ ਪਹਿਲੀ ਵਾਰ ਮੀਸ਼ੋ ਤੋਂ ਟੀ ਸ਼ਰਟ ਮੰਗਵਾਈ ਸੀ ਜਿਵੇਂ ਦੀ ਉਹ ਮੈਨੂੰ ਫੋਟੋ ਦੇ ਵਿੱਚ ਦਿਖ ਰਹੀ ਸੀ ਮੈਨੂੰ ਉਸੇ ਤਰ੍ਹਾਂ ਹੀ ਬਿਲਕੁਲ ਡਿੱਟੋ ਰਸੀਵ ਹੋਈ ਉਸ ਦਾ ਸਟਫ ਕਲਰ ਐਂਡ ਸਭ ਕੁਛ ਬਹੁਤ ਜ਼ਿਆਦਾ ਵਧੀਆ ਸੀ ਜਦੋਂ ਵੀ ਮੈਂ ਉਹ ਟੀ ਸ਼ਰਟ ਪਾ ਕੇ ਕਿਸੇ ਵੀ ਫੰਕਸ਼ਨ 'ਤੇ ਜਾਂਦੀ ਹਾਂ ਮੈਨੂੰ ਹਰ ਕੋਈ ਉਸ ਟੀ ਸ਼ਰਟ ਬਾਰੇ ਪੁੱਛਦਾ ਆ ਮੈਨੂੰ ਉਹ ਟੀ ਸ਼ਰਟ ਬਹੁਤ ਹੀ ਵਧੀਆ ਲੱਗੀ ਬਹੁਤ ਜ਼ਿਆਦਾ ਕੰਫਰਟੇਬਲ ਆ ਉਹ ਟੀ ਸ਼ਰਟ ਈਵਨ ਜਿਸ ਡੇਟ 'ਤੇ ਉਹਨਾਂ ਨੇ ਡਲੀਵਰੀ ਲਿਖੀ ਹੋਈ ਸੀ ਉਸ ਡੇਟ 'ਤੇ ਹੀ ਮੈਨੂੰ ਇਹ ਟੀ ਸ਼ਰਟ ਮਿਲੀ ਈਵਨ ਡਲੀਵਰੀ ਬੋਆਏ ਦਾ ਜੋ ਬੀਹੇਵੀਅਰ ਸੀ ਉਹ ਵੀ ਬਹੁਤ ਵਧੀਆ ਸੀ ਜੋ ਪ੍ਰਾਈਜ ਸੀਗਾ ਇਸ ਟੀ ਸ਼ਰਟ ਦਾ ਉਹ ਵੀ ਬਹੁਤ ਜ਼ਿਆਦਾ ਵਧੀਆ ਸੀਗਾ ਮੈਨੂੰ ਇਹ ਟੀ ਸ਼ਰਟ ਮੰਗਵਾ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਇਹਦੀ ਹਰ ਇੱਕ ਚੀਜ਼ ਬਹੁਤ ਵਧੀਆ ਸੀ ਈਵਨ ਕੋਲਰਜ ਹਰ ਇੱਕ ਮਤਲਬ ਬਹੁਤ ਜ਼ਿਆਦਾ ਇਹ ਟੀ ਸ਼ਰਟ ਕੰਫਰਟੇਬਲ ਆ